ਹੈਲੋ ਸਤਿ ਸ਼੍ਰੀ ਅਕਾਲ ਮੈਮ ਬਸ ਠੀਕ ਠਾਕ ਤੁਸੀਂ ਸੁਣਾਓ ਜੀ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਇ ਇਸ ਵਿਸ਼ੇ 'ਤੇ ਥੋੜ੍ਹੇ ਦਿਨ ਪਹਿਲਾਂ ਪੜ੍ਹਿਆ ਵੀ ਹੈ ਔਰ ਸੋਚਿਆ ਵੀ ਕਿਉਂਕਿ ਅੱਜ ਕੱਲ੍ਹ ਜੋ ਬੱਚਿਆਂ ਦਾ ਟਰੈਂਡ ਆ ਮੇਨ ਉਹ ਕੰਪਿਊਟਰ ਸਬਜੈਕਟ ਦੇ ਵਿੱਚ ਜ਼ਿਆਦਾ ਔਰ ਉੱਧਰ ਬੱਚੇ ਕਾਫੀ ਜਾ ਰਹੇ ਨੇ ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜੋਬਸ ਜਿਹੜੀਆਂ ਨੇ ਉਹ ਮਿਲਣ ਦੀ ਸੰਭਾਵਨਾਵਾਂ ਹੈ ਅਤੇ ਬੱਚੇ ਸਫਟਵੇਅਰ ਜਾਂ ਹੋਰ ਜਿਹੜੇ ਕੰਪਿਊਟਰ ਨਾਲ ਜੁੜੇ ਵਿਸ਼ੇ ਨੇ ਉਹਨਾਂ ਵਿੱਚ ਕਾਫੀ ਰੁਚੀ ਰੱਖਦੇ ਨੇ ਔਰ ਉਹਨਾਂ ਨੂੰ ਉੱਧਰ ਕੰਪਨੀਆਂ ਵੱਲੋਂ ਕੰਮ ਜਲਦੀ ਮਿਲ ਜਾਂਦਾ ਅਤੇ ਇਸ ਤਰੀਕੇ ਨਾਲ ਹਾਂਜੀ ਅਤੇ ਇਸ ਤਰੀਕੇ ਨਾਲ ਵੀ ਇਹ ਇਹ ਵੀ ਕਾਫੀ ਵਧੀਆ ਲੱਗ ਰਿਹਾ ਵੀ ਬੱਚਿਆਂ ਦੇ ਜੋ ਫੀਲਡ ਦਾ ਇੰਟਰਸਟ ਆ ਉਹ ਕੰਪਿਊਟਰ ਦੇ ਵਿੱਚ ਜ਼ਿਆਦਾ ਅਤੇ ਤੁਹਾਡਾ ਕੋਈ ਇਹਦੇ ਨਾਲ ਸੰਬੰਧਿਤ ਹੋਰ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ ਓਂ ਹਾਂਜੀ

ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਮੈਮ ਧੰਨਵਾਦ ਜੀ